ਪੰਜਾਬ ਵਿੱਚ ਰਿਆਇਤੀ ਕਿੱਤੇ ਬਹੁਤ ਹਨ ਜਿਵੇਂ ਕਿ ਖੇਤੀਬਾੜੀ ਖੇਤੀਬਾੜੀ ਵਿੱਚ ਅਸੀਂ ਆਲੂ ਪਿਆਜ ਕਣਕ ਧਾਨ ਆਦਿ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਵਪਾਰ ਵਿੱਚ ਅਸੀਂ ਕੱਪੜੇ ਦਾ ਵਪਾਰ ਜੁੱਤੀਆਂ ਦਾ ਵਪਾਰ ਹੋਰ ਕਈ ਤਰ੍ਹਾਂ ਦੇ ਵਪਾਰ ਕਰਦੇ ਹਨ ਜਿਵੇਂ ਕਿ ਹੁ ਅੱਜ ਕੱਲ੍ਹ ਨਹੀਂ ਨੌਕਰੀਆਂ ਮਿਲਦੀਆਂ ਅਤੇ ਆਪਣਾ ਰੈਸਟੋਰੈਂਟ ਖੋਲਦੇ ਹਨ ਅਤੇ ਹੋਰ ਫਾਸਟ ਫੂਡ ਆਦਿ ਦਾ ਵਪਾਰ ਕਰਦੇ ਹਨ ਹੋਰ ਕਾਫੀ ਚੀਜ਼ਾਂ ਦਾ ਵਪਾਰ ਕੀਤਾ ਜਾਂਦਾ ਹੈ